ਮੇਰਾ ਮੰਨਣਾ ਇਹ ਹੈ ਕਿ ਜਿਵੇਂ ਪੇਂਡੂ ਖੇਤਰ ਹਨ ਉਹਨਾਂ ਵਿੱਚ ਲੋਕ ਜ਼ਿਆਦਾਤਰ ਮਿਲ ਜੁਲ ਕੇ ਹੀ ਰਹਿੰਦੇ ਹਨ ਲੜ ਲੜਾਈਆਂ ਘੱਟ ਹੁੰਦੀਆਂ ਹਨ ਪਰ ਇਹਦੇ ਵਿੱਚ ਉਹਨਾਂ ਓਹ ਮਿਲ ਜੁਲ ਕੇ ਇੰਨਾਂ ਸੁਧਾਰ ਨਹੀਂ ਲਿਆ ਸਕਦੇ ਜਿੰਨਾਂ ਇੱਕ ਸਰਕਾਰ ਉੱਥੇ ਦਾ ਐਮ ਐਲ ਏ ਉੱਥੇ ਦਾ ਮੰਤਰੀ ਜਾਂ ਉਸ ਪੰਜਾਬ ਦਾ ਸੀ ਐਮ ਲੈ ਕੇ ਆ ਸਕਦਾ ਹੈ ਕਿਉਂਕਿ ਸਭ ਕੋਲ ਇੰਨਾਂ ਪੈਸਾ ਨਹੀਂ ਕਿ ਕੋਈ ਆਪਣੇ ਘਰ ਨੂੰ ਵੀ ਲਾਵੇ ਅਤੇ ਦੂਜਿਆਂ ਦੇ ਘਰ ਨੂੰ ਵੀ ਤਾਂ ਮੈਂ ਸੋਚਦੀ ਹਾਂ ਕਿ ਪੰਜਾਬ ਸਰਕਾਰ ਨੂੰ ਕੁਝ ਕਿਸਾਨ ਇੱਦਾਂ ਦੇ ਹੁੰਦੇ ਹਨ ਜੋ ਕਿ ਇੰਨਾਂ ਪੈਸਾ ਖਰਚ ਕੇ ਬੀਜ ਨਹੀਂ ਖਰੀਦ ਸਕਦੇ ਨਵਾਂ ਉਹਨੂੰ ਨਹੀਂ ਖੇਤੀ ਕਰ ਸਕਦੇ ਤਾਂ ਅੱਜ ਕੱਲ੍ਹ ਲੋਕ ਕੀ ਕਰ ਰਹੇ ਨੇ ਖੇਤੀਬਾੜੀ ਛੱਡ ਕੇ ਹੋਰ ਕੰਮ ਲੱਭਣ ਜਾ ਰਹੇ ਨੇ ਜੇ ਪੰਜਾਬ ਸਰਕਾਰ ਜ਼ਿਆਦਾ ਨਹੀਂ ਘੱਟੋ ਘੱਟ ਬੀਜ ਜੋਗੇ ਪੈਸੇ ਉਹਨਾਂ ਦੇ ਖਾਤੇ ਵਿੱਚ ਪਾਵੇ ਤਾਂ ਉਹ ਉਸ ਪੈਸੇ ਦਾ ਬੀਜ ਖਰੀਦ ਕੇ ਆਪਣੇ ਖੇਤਾਂ ਵਿੱਚ ਲਾ ਸਕਦੇ ਹਨ ਜਿਵੇਂ ਕਿ ਪੰਜ ਸੱਤ ਲੋਕਾਂ ਦੇ ਖੇਤ ਇੱਕੇ ਨਾਲ ਹਨ ਤਾਂ ਉੱਥੇ ਸਰਕਾਰ ਇੱਕ ਮੋਟਰ ਲਵਾ ਦੇ ਤਾਂ ਕਿ ਜੇ ਇੱਕ ਬੰਦੇ ਦਾ ਖੇਤ ਪਾਣੀ ਨਾਲ ਭਰ ਜਾਵੇ ਤਾਂ ਸਾਰੇ ਉੱਥੋਂ ਹੀ ਲੈ ਸਕਣ ਕਿਉਂਕਿ ਇਸ ਤਰੀਕੇ ਨਾਲ ਵੀ ਉਹਨਾਂ ਲੋਕਾਂ ਦੀ ਬਹੁਤ ਮਦਦ ਹੋਵੇਗੀ ਅਤੇ ਖੇਤੀਬਾੜੀ ਵਿੱਚ ਸੁਧਾਰ ਆਵੇਗਾ ਇਸ ਤਰੀਕੇ ਨਾਲ ਹੀ ਲੋਕ ਖੇਤੀਬਾੜੀ ਨਾਲ ਜੁੜੇ ਰਹਿਣਗੇ ਕਿਉਂਕਿ ਅੱਜ ਕੱਲ੍ਹ ਖੇਤੀਬਾੜੀ 'ਚ ਵੀ ਖਰਚਾ ਬਹੁਤ ਹੁੰਦਾ ਏ ਅਤੇ ਹਰੇਕ ਬੰਦਾ ਇੰਨਾਂ ਨਹੀਂ ਕਮਾਉਂਦਾ ਅਤੇ ਇੰਨਾਂ ਨਹੀਂ ਖਰਚ ਕਰ ਸਕਦਾ ਇਸ ਕਰਕੇ ਲੋਕ ਖੇਤੀਬਾੜੀ ਛੱਡ ਕੇ ਹੋਰ ਕੰਮ ਕਰਨ ਨੂੰ ਬਿਹਤਰ ਸਮਝਦੇ ਹਨ ਤਾਂ ਸਾਡੀ ਸਰਕਾਰ ਨੂੰ ਉਹਨਾਂ ਦੀ ਥੋੜ੍ਹੀ ਜਿਹੀ ਮਦਦ ਕਰਨੀ ਚਾਹੀਦੀ ਹੈ ਜਿਸ ਕਰਕੇ ਖੇਤੀਬਾੜੀ ਵਿੱਚ ਵਾਧਾ ਵੀ ਪਾ ਸਕਣ ਅਤੇ ਸੁਧਾਰ ਵੀ ਹੋ ਸਕੇ